ਭਾਰਤੀ ਅਰਥ ਵਿਵਸਥਾ ਨੇ ਹਾਲ ਹੀ ਦੇ ਸਾਲਾਂ ਵਿੱਚ ਲਗਭਗ ਸਾਰੇ ਹੀ ਖੇਤਰਾਂ ਵਿੱਚ ਵਾਧਾ ਅਤੇ ਵਿਕਾਸ ਦੇਖਿਆ ਹੈ ਇਸ ਵਾਧੇ ਵਿੱਚ ਮੁੱਖ ਯੋਗਦਾਨ ਆਈ ਟੀ ਸੈਕਟਰ ਦਾ ਹੈ ਭਾਰਤ ਇੱਕ ਗਲੋਬਲ ਆਈ ਟੀ ਹੱਬ ਦੇ ਰੂਪ ਵਿੱਚ ਉਭਰਿਆ ਹੈ ਜਿਸ ਵਿੱਚ ਸੋਫਟਵੇਅਰ ਸੇਵਾਵਾਂ ਆਈ ਟੀ ਸਲਾਹਕਾਰਾਂ ਅਤੇ ਬੀ ਪੀ ਓ ਇਸ ਦੇ ਆਰਥਿਕ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ ਇਸ ਤੋਂ ਇਲਾਵਾ ਫਾਰਮਾਸਿਟੀਕਲ ਅਤੇ ਸਿਹਤ ਸੰਭਾਲ ਉਦਯੋਗ ਆਰਥਿਕ ਵਿਕਾਸ ਦਾ ਮੁੱਖ ਜਰੀਆ ਰਿਹਾ ਹੈ ਭਾਰਤ ਗਲੋਬਲ ਫਾਰਮਾਸਿਟੀਕਲ ਮਾਰਕੀਟ ਵਿੱਚ ਇੱਕ ਵੱਡਾ ਖਿਡਾਰੀ ਹੈ ਜੋ ਕਿ ਦੁਨੀਆਂ ਭਰ ਵਿੱਚ ਜੈਨਿਕ ਦਵਾਈਆਂ ਦੀ ਸਪਲਾਈ ਕਰਦਾ ਹੈ ਇਸ ਤੋਂ ਇਲਾਵਾ ਦੇਸ਼ ਦੇ ਹੁਨਰਬੰਦ ਅਤੇ ਖੋਜ ਅਤੇ ਵਿਕਾਸ ਵਿੱਚ ਮੁਹਾਰਤ ਹਾਸਲ ਕੀਤੇ ਲੋਕਾਂ ਨੇ ਇਸ ਖੇਤਰ ਦੇ ਵਿਕਾਸ ਨੂੰ ਅੱਗੇ ਵਧਾਇਆ ਹੈ ਨਿਰਮਾਨ ਖੇਤਰ ਖਾਸ ਤੌਰ 'ਤੇ ਆਟੋਮੋਟਿਵ ਅਤੇ ਇਲੈਕਟ੍ਰੋਨਿਕਸ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਤਰੱਕੀ ਦੇਖੀ ਗਈ ਹੈ ਮੇਕ ਇਨ ਇੰਡੀਆ ਦੀ ਪਹਿਲਕਦਮੀ ਸਦਕਾ ਜਿਸ ਦਾ ਉਦੇਸ਼ ਸਵਦੇਸ਼ੀ ਨਿਰਮਾਣ ਨੂੰ ਉਤਸਾਹਿਤ ਕਰਨਾ ਹੈ ਨਿਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਘਰੇਲੂ ਨਿਵੇਸ਼ਾਂ ਨੂੰ ਆਕਰਸ਼ਿਤ ਕੀਤਾ ਹੈ ਇੰਟਰਨੈਟ ਬੈਂਕਿੰਗ ਅਤੇ ਜ ਡਿਜੀਟਲ ਪੇਮੈਂਟਸ ਨੇ ਵੀ ਭੁਗਤਾਨਾਂ ਨੂੰ ਵਿੱਤੀ ਸਮਾਂਵੇਸ਼ ਅਤੇ ਕੁਸ਼ਲਤਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸਮਾਰਟ ਫੋਨਾਂ ਨੂੰ ਵਧਾ ਕੇ ਡਿਜੀਟਲ ਭੁਗਤਾਨਾਂ ਦੇ ਵਾਧੇ ਦੀ ਸਹੂਲਤ ਵੀ ਦਿੱਤੀ ਗਈ ਹੈ ਯੂ ਪੀ ਆਈ ਸਮੇਤ ਡਿਜੀਟਲ ਪੇਮੈਂਟਾਂ ਨੇ ਭਾਰਤ ਵਿੱਚ ਭੁਗਤਾਨ ਦੇ ਲੈਂਡਸਕੇਪ ਨੂੰ ਬਦਲ ਦਿੱਤਾ ਹੈ ਦੋ ਹਜ਼ਾਰ ਸੌਲ੍ਹਾਂ ਵਿੱਚ ਨੋਟਬੰਦੀ ਦਾ ਡਿਜੀਟਲ ਪੇਮੈਂਟਸ ਨੂੰ ਵਧਾਉਣ ਵਿੱਚ ਬਹੁਤ ਵੱਡਾ ਹੱਥ ਹੈ ਹੁਣ ਇਸ ਦੀ ਸਹਾਇਤਾ ਨਾਲ ਲੋਕ ਘਰ ਬੈਠੇ ਹੀ ਵਪਾਰ ਕਰੀ ਜਾ ਰਹੇ ਹਨ ਅਖੀਰ ਮੈਂ ਤਾਂ ਇਹੀ ਕਹਾਂਗੀ ਕਿ ਇੰਟਰਨੈਟ ਬੈਂਕਿੰਗ ਅਤੇ ਡਿਜੀਟਲ ਭੁਗਤਾਨਾਂ ਦੇ ਏਕੀਕਰਨ ਨੇ ਤਾਂ ਨਾ ਸਿਰਫ ਵਿੱਤੀ ਖੇਤਰ ਦਾ ਆਧੁਨਿਕੀਕਰਨ ਕੀਤਾ ਹੈ ਬਲਕਿ ਆਰਥਿਕ ਤਰੱਕੀ ਵਿੱਚ ਵੀ ਯੋਗਦਾਨ ਪਾਇਆ ਹੈ